ਇੱਕ ਚੰਗੀ ਫੋਟੋ ਖਿੱਚਣ ਲਈ ਹੀ ਚੰਗਾ ਬੈਕਗ੍ਰਾਊਡ ਹੋਣਾ ਚਾਹੀਦਾ ਹੈ ਅਤੇ ਵਧੀਆ ਕੁਆਲਟੀ ਦਾ ਕੈਮਰਾ ਹੋਣਾ ਚਾਹੀਦਾ ਹੈ ਅਤੇ ਵਧੀਆ ਪਨਸੈਲਟੇਡ ਕੱਪੜੇ ਹੋਣੇ ਚਾਹੀਦੇ ਹਨ ਅਤੇ ਵਧੀਆ ਜਿਹੜਾ ਜ਼ੂਮ ਆਊਟ ਹੋਵੇ ਉੱਦਾਂ ਦਾ ਕੈਮਰਾ ਚਾਹੀਦਾ ਹਨ ਜਿਹੜੇ ਜਿਵੇਂ ਕਿ ਅੱਜ ਕੱਲ੍ਹ ਬੜੇ ਕਲੈਰਟੀਦਾਰ ਕੈਮਰਾ ਆ ਰਹੇ ਹਨ ਲਾਈਕ ਸੋਨੀ ਦਾ ਕੈਮਰਾ ਹੋ ਗਿਆ ਕੈਨੋਨ ਦਾ ਹੋ ਗਿਆ ਅਤੇ ਪੋਜ਼ ਮਾਰਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਫੋਟੋਜ਼ ਖਿੱਚਣ ਲਈ ਐਜ਼ ਅ ਮੈਮਰੀ ਰੱਖਣ ਲਈ